ਮੈਂ ਨਾ ਫੋਨ ਲੈਣਾ ਸੀ ਇੱਕ ਅਤੇ ਮੈਂ ਫੋਨ ਲੈਣ ਲਈ ਨਾ ਆਨਲਾਈਨ ਫੋਨ ਚੈੱਕ ਕੀਤਾ ਦੇਖਿਆ ਉਹ ਮੈਨੂੰ ਬੜਾ ਵਧੀਆ ਲੱਗਿਆ ਅਤੇ ਮੈਂ ਬੁੱਕ ਕਰਤਾ ਆਨਲਾਈਨ ਪਰ ਜਦੋਂ ਆਇਆ ਮੈਂ ਵੇਖਿਆ ਵੀ ਪਹਿਲਾਂ ਗੱਲ ਤਾਂ ਉਹਦੀ ਪੈਕਿੰਗ ਜਿਹੜੀ ਖੁੱਲ੍ਹੀ ਹੋਈ ਸੀ ਪਹਿਲਾਂ ਮੈਨੂੰ ਲੱਗਿਆ ਇੱਦਾਂ ਵੀ ਖੁੱਲ੍ਹੀ ਆ ਥੋੜ੍ਹੀ ਬਹੁਤੀ ਫਿਰ ਮੈਂ ਉਹਨੂੰ ਖੋਲ੍ਹਿਆ ਚੈੱਕ ਕੀਤਾ ਅਤੇ ਮੈਂ ਵਿੱਚ ਕੀ ਦੇਖਦਾ ਮੈਂ ਮੰਗਵਾਇਆ ਬਲੈਕ ਕਲਰ ਦਾ ਪਰ ਉਹਦੇ ਵਿੱਚ ਫੋਨ ਹੈਗਾ ਵਾਈਟ ਕਲਰ ਦਾ ਚਿੱਟੇ ਰੰਗ ਦਾ ਕਲਰ ਮੰਗਵਾਇਆ ਕਾਲੇ ਰੰਗ ਦਾ ਵਾ ਆਇਆ ਚਿੱਟੇ ਰੰਗ ਦਾ ਵਾ ਪਤਾ ਨਹੀਂ ਕੰਪਨੀਆਂ ਵਾਲੇ ਕੀ ਦੇਖ ਕੇ ਭੇਜਦੇ ਆ ਅਤੇ ਉਹਦੇ ਤੋਂ ਬਾਅਦ ਫਿਰ ਮੈਂ ਉਹਨੂੰ ਚੈੱਕ ਕੀਤਾ ਭੱਜੇ ਹੋਏ ਆ ਫੋਟੋ ਦੇ ਉੱਤੇ ਉਹਨਾਂ ਦਾ ਦਿਖਾ ਰਹੇ ਸੀ ਸ਼ੋ ਕਰ ਰਹੇ ਸੀਗੇ ਲੱਗ ਰਿਹਾ ਸੀਗਾ ਉਸ ਹਿਸਾਬ ਨਾਲ ਇਹਦੇ ਬਾਹਲਾ ਦੇਖਣ ਨੂੰ ਨਿੱਕਾ ਜਿਹਾ ਲੱਗ ਰਿਹਾ ਉਹਦੇ ਉੱਤੇ ਵੱਡਾ ਲੱਗ ਰਿਹਾ ਸੀਗਾ ਕਾਫ਼ੀ ਡੋਮੇਸ਼ ਡਮੇਸ਼ਨਿੰਗ ਦੇ ਵਿੱਚ ਪਰ ਜਦੋਂ ਚੈੱਕ ਕੀਤਾ ਹੱਥ 'ਚ ਫੜ ਕੇ ਬਿਲਕੁਲ ਨਿੱਕਾ ਜਿਹਾ ਅਤੇ ਫਿਰ ਜਦੋਂ ਮੈਂ ਖੋਲ ਕੇ ਚੈੱਕ ਕੀਤਾ ਰੈਮ ਵਗੈਰਾ ਚੈੱਕ ਕੀਤੀ ਅਤੇ ਮੈਂ ਅੱਠ ਜੀ ਬੀ ਰੈ ਰੈਮ ਸੀਗੀ ਕਹੀ ਹੋਈ ਇਹਦੇ ਵਿੱਚ ਸਿਰਫ਼ ਛੇ ਜੀ ਬੀ ਰੈਮ ਆ ਅਤੇ ਜਿਹੜੀ ਮੈਮਰੀ ਆ ਉਹ ਵੀ ਮੈਂ ਦੋ ਸੋ ਛਪੰਜਾ ਜੀ ਬੀ ਜਿਹੜੀ ਮੈਮਰੀ ਆ ਉਹ ਦੇਖ ਕੇ ਉਹ ਬੁੱਕ ਕੀਤਾ ਸੀਗਾ ਇਹ ਇੱਕ ਸੌ ਅਠਾਈ ਆ ਪਤਾ ਨਹੀਂ ਕੰਪਨੀ ਵਾਲਿਆਂ ਨੂੰ ਕੀ ਦਿਖਿਆ ਗਲਤੀ ਦੇ ਨਾਲ ਉਹਨਾਂ ਨੇ ਘੱਲ ਤਾ ਵਾ ਅਤੇ ਜਾਂ ਕੀ ਚੱਕਰ ਆ ਰੰਗ ਵੀ ਬਦਲਤਾ ਹੈ ਵੀ ਉਹ ਨਹੀਂ ਖੁੱਲ੍ਹੀ ਪੈਕਿੰਗ ਵੀ ਖੁੱਲ੍ਹੀ ਆ ਅਤੇ ਸਾਈਜ਼ ਵੀ ਜਿਹੜਾ ਛੋਟਾ ਲੱਗ ਰਿਹਾ ਦੇਖਣ ਨੂੰ ਸਾਰਾ ਕੁਛ ਹੀ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ ਕਹਿਣ ਦਾ ਮਤਲਬ ਵੀ ਪਤਾ ਨਹੀਂ ਕੀ ਚੱਕਰ ਆ